ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸਾਨੂੰ ਸੁਰੱਖਿਅਤ ਰਹਿਣ ਲਈ ਬਹੁਤ ਕੁਝ ਤਰੀਕੇ ਵਰਤਣੇ ਚਾਹੀਦੇ ਹਨ ਜਿਵੇਂ ਕਿ ਆਪਾਂ ਨੂੰ ਅੱਖਾਂ ਵਿੱਚ ਪਾਣੀ ਨਾ ਜਾਣ ਅਤੇ ਸਹੀ ਵਿਜ਼ੀਬਿਲਿਟੀ ਦੇ ਲਈ ਅੱਖਾਂ ਦੇ ਵਿੱਚ ਵੱਟਰ ਗਲਾਸਸ ਪਹਿਨਣੇ ਜ਼ਰੂਰੀ ਹਨ ਕੰਨਾਂ ਵਿੱਚ ਪਾਣੀ ਨਾ ਜਾਣ ਲਈ ਆਪਾਂ ਨੂੰ ਕੰਨਾਂ ਵਿੱਚ ਈਅਰ ਬਡਸ ਪਹਿਨਣੇ ਜ਼ਰੂਰੀ ਹਨ ਪਾਣੀ ਦਾ ਵਹਾਅ ਚੈੱਕ ਕਰਨਾ ਵੀ ਬਹੁਤ ਜ਼ਰੂਰੀ ਹੈ ਅਤੇ ਪਾਣੀ ਦੀਆਂ ਲਹਿਰਾਂ ਵੀ ਚੈਕ ਦੇਖਣਾ ਜ਼ਰੂਰੀ ਹੈ ਕਿ ਉਹ ਜ਼ਿਆਦਾ ਉੱਚੀਆਂ ਨਾ ਜਾਣ ਅਤੇ ਅਸੀਂ ਉਹਨਾਂ ਵਿੱਚ ਕਿਤੇ ਡੁੱਬ ਹੀ ਨਾ ਜਾਈਏ ਪਾਣੀ ਵਿੱਚ ਕਈ ਵਾਰ ਚਟਾਨਾਂ ਹੁੰਦੀਆਂ ਹਨ ਜੋ ਕਿ ਜ਼ਿਆਦਾ ਤਿਲਕਣ ਵਾਲੀਆਂ ਹੁੰਦੀਆਂ ਹਨ ਅਤੇ ਉਹਨਾਂ ਉੱਤੇ ਪੈਰ ਟਿਕਣ ਸਾਰ ਆਪਣਾ ਆਪਾਂ ਤਿਲਕ ਕੇ ਡਿੱਗ ਸਕਦੇ ਹਾਂ ਤਾਂ ਉਹਨਾਂ ਚਟਾਨਾ ਤੋਂ ਆਪਾਂ ਨੂੰ ਬਚਣ ਦੀ ਜ਼ਰੂਰਤ ਹੈ ਕਈ ਵਾਰ ਐਲਗੀ ਵੀ ਕਈ ਥਾਵਾਂ ਉੱਤੇ ਜੰਮੀ ਹੁੰਦੀ ਹੈ ਜਿਸ ਨਾਲ ਪਾਣੀ ਵਿੱਚ ਥਾਂ ਤਿਲਕਣ ਵਾਲੀ ਬਣ ਜਾਂਦੀ ਹੈ ਅਤੇ ਤੇਜ਼ ਵਹਾਅ ਵਾਲਾ ਪਾਣੀ ਵੀ ਆਪਾਂ ਨੂੰ ਕਈ ਵਾਰ ਰੋੜ੍ਹ ਕੇ ਲੈ ਕੇ ਜਾ ਸਕਦਾ ਹੈ ਇਸ ਲਈ ਸਾਨੂੰ ਉਸ ਦੀ ਪਹਿਲਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਪਾਣੀ ਵਿੱਚ ਤੈਰਨ ਤੋਂ ਪਹਿਲਾਂ ਇਹ ਵੀ ਜ਼ਰੂਰੀ ਚਾਹੀਦਾ ਹੈ ਕਿ ਪਾਣੀ ਵਿੱਚ ਆਪਾਂ ਜ਼ਿਆਦਾ ਡੂੰਘੇ ਨਾ ਜਾਈਏ ਤਾਂ ਜੋ ਆਪਣਾ ਵਾਪਸ ਮੁੜਨਾ ਔਖਾ ਹੋ ਸਕੇ ਅਤੇ ਆਪਾਂ ਨੂੰ ਹੋ ਸਕੇ ਤਾਂ ਆਪਣੇ ਸਾਥੀਆਂ ਦੇ ਨਾਲ ਹੀ ਤੈ ਤੈਰਾਕੀ ਕਰਨ ਜਾਣਾ ਚਾਹੀਦਾ ਹੈ ਅਤੇ ਕੋਈ ਰੱਸੀ ਜਾਂ ਕੋਈ ਕੱਪੜਾ ਬੰਨ੍ਹ ਕੇ ਵੀ ਕਿਸੇ ਤੈਰਾਕੀ ਕਰਨੀ ਚਾਹੀਦੀ ਹੈ